ਛੋਟੇ ਪੱਧਰ ਦੇ ਕਿਸਾਨਾਂ ਨੂੰ ਕਈ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਰਿਸ਼ ਮੀ ਮੀਂਹ ਪੈਣ ਦੇ ਕਾਰਨ ਉਹਨਾਂ ਦਾ ਫਸਲ ਖ਼ਰਾਬ ਹੋ ਜਾਂਦਾ ਹੈ ਅਤੇ ਕਈ ਅਣਚਾਹੇ ਜਾਨਵਰ ਉਹਨਾਂ ਦੇ ਖੇਤਾਂ ਵਿੱਚ ਵੜ ਕੇ ਉਹਨਾਂ ਦੇ ਫਸਲ ਨੂੰ ਖ਼ਰਾਬ ਕਰਦੇ ਨੇ ਅਤੇ ਅਣਚਾਹੇ ਮੀਂਹ ਉਹਨਾਂ ਦੇ ਫਸਲਾਂ ਨੂੰ ਖ਼ਰਾਬ ਕਰਦੇ ਨੇ ਉਹਨਾਂ ਨੂੰ ਖੇਤਾਂ ਵਿੱਚ ਹਰ ਤਰ੍ਹਾਂ ਦੀ ਫੈਸੀਲੀਟੀ ਮੌਜੂਦ ਨਹੀਂ ਹੁੰਦੀ ਜਿਸ ਕਰਕੇ ਉਹ ਆਪਣੇ ਆਪਣੇ ਖੇਤਾਂ ਨੂੰ ਸਹੀ ਤਰ੍ਹਾਂ ਕੇ ਦੇ ਉਹਨਾਂ ਨੂੰ ਫਸਲ ਨਹੀਂ ਪ੍ਰਾਪਤ ਕਰ ਸਕਦੇ ਉਹ ਉਹਨਾਂ ਨੂੰ ਸਰਕਾਰ ਸਰਕਾਰ ਨੂੰ ਇਹ ਹੁਣ ਇਹ ਦੇਣਾ ਚਾਹੀਦਾ ਹੈ ਇੱਕ ਛੋਟੇ ਪੱਧਰ ਕਿਸਾਨਾਂ ਨੂੰ ਕਿ ਤਾਂ ਕਿ ਉਹ ਉਹਨਾਂ ਨੂੰ ਸਹੀ ਮੁਆਵਜ਼ਾ ਦੇਵੇ ਜ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਫਸਲ ਖ਼ਰਾਬ ਹੋ ਤਾਂ ਉਹਨਾਂ ਦੀ ਭਰਪਾਈ ਹੋ ਸਕੇ ਅਤੇ ਉਹ ਅੱਛੇ ਤਰ੍ਹਾਂ ਦੇ ਖੇਤੀ ਕਰ ਸਕਣ ਉਹਨਾਂ ਨੂੰ ਉਹਦੇ ਬਾਰੇ ਹਰ ਚੀਜ਼ ਦੱਸਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਹਰ ਸਮਾਨ ਦਾ ਸਮਾਨ ਦੇਣਾ ਚਾਹੀਦਾ ਹੈ ਜਿਸ ਕਰਕੇ ਉਹਨਾਂ ਨੂੰ ਫਸਲ ਨੂੰ ਉਗਾਉਣ ਵਿੱਚ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਨੂੰ ਹਰ ਮੁਸ਼ਕਲਾਂ ਚ ਸਹੀ ਤਰੀਕੇ ਨਾਲ ਬਚ ਸਕੇ ਉਹਨਾਂ ਨੂੰ ਕੀਟਨਾਸ਼ਕ ਉਹ ਥੋੜ੍ਹੀ ਕਮ ਰੇਟ 'ਤੇ ਦਿੱਤੇ ਜਾਵੇ ਤਾਂ ਕਿ ਉਹ ਗਰੀਬ ਕਿਸਾਨ ਵੀ ਉਹਨਾਂ ਨੂੰ ਖ਼ਰੀਦ ਕੇ ਆਪਣੇ ਫਸਲਾਂ ਵਿੱਚ ਪਾ ਦੇਣ ਤਾਂ ਕਿ ਉਹਨਾਂ ਨੂੰ ਫਸਲ ਸਹੀ ਤੰਦਰੁਸਤ ਉੱਗਣ